ਹੈਲੋ ਹਾਂਜੀ ਗੁੱਡ ਮੋਰਨਿੰਗ ਸਰ ਗੁੱਡ ਮੋਰਨਿੰਗ ਮੈਮ ਮੈਂ ਤੁਹਾਡੇ ਇਮਪਲੋਈ ਬੋਲ ਰਿਹਾ ਐਕਚੁਲੀ ਮੈਮ ਮੈਂ ਨਾ ਆਪਣੇ ਇੰਕਰੀਮੈਂਟ ਵਾਸਤੇ ਐਪਲੀਕੇਸ਼ਨ ਲਗਾਉਣੀ ਸੀਗੀ ਅਤੇ ਮੈਂ ਆਪਣੇ ਰਿਵਿਊ ਪੁੱਛਣੇ ਸੀਗੇ ਕਿ ਕਿਵੇਂ ਦਾ ਕੰਮ ਹੈ ਇਸ ਮੰਥ ਮੇਰਾ ਮੈਮ ਮੇਰਾ ਨਾਮ ਹੈ ਜਤਿੰਦਰ ਕੌਰ ਔਰ ਮੈਂ ਇਸ ਈਅਰ ਦਾ ਆਪਣਾ ਪੂਰਾ ਪਲੈਨਰ ਪੁੱਛਣਾ ਸੀਗਾ ਕਿ ਮੇਰੇ ਰਿਵਿਊ ਕਿਸ ਤਰੀਕੇ ਦੇ ਹੈ ਇਸ ਬਾਰ ਸੋ ਮੈਂ ਆਪਣਾ ਇੰਕਰੀਮੈਂਟ ਵਾਸਤੇ ਐਪਲੀਕੇਸ਼ਨ ਪਾ ਸਕਾਂ ਮੈਮ ਛੁੱਟੀਆਂ ਤਾਂ ਮੇਰੀ ਉਹ ਕੁਛ ਮੈਡਮ ਹੈਲਥ ਇਸ਼ੂ ਸੀਗੇ ਤੁਹਾਨੂੰ ਵੀ ਪਤਾ ਸੀਗਾ ਕਿ ਮੇਰੇ ਹੈਲਥ ਇਸ਼ੂ ਹੋਣ ਕਰਕੇ ਮੈਂ ਸਿਕ ਲੀਵ ਪਾਈ ਹੋਈ ਸੀਗੀ ਬਟ ਐਕਚੁਲੀ ਮੈਡਮ ਸਿਕ ਲੀਵ ਉਹਦੇ ਵਿੱਚ ਬਿਮਾਰ ਜਦੋਂ ਹੈਲਥ ਇਸ਼ੂ ਹੈ ਉਦੋਂ ਤਾਂ ਅਸੀਂ ਕੁਛ ਨਹੀਂ ਕਰ ਸਕਦੇ ਨਾ ਪ੍ਰੋਬਲਮ ਹੋ ਜਾਂਦੀ ਹੈ ਥੋੜ੍ਹੀ ਅਤੇ ਫਿਰ ਮਤਲਬ ਛੁੱਟੀ ਕਰਨੀ ਪਈ ਮੈਨੂੰ ਅਦਰਵਾਈਜ਼ ਤਾਂ ਮੇਰਾ ਪਿਛਲਾ ਰਿਕਾਰਡ ਤੁਸੀਂ ਚੈੱਕ ਕਰੋ ਨਹੀਂ ਕੁਛ ਵੀ ਛੁੱਟੀਆਂ ਨਹੀਂ ਜ਼ਿਆਦਾ ਹੈਗੀਆਂ

ਹਾਂਜੀ ਮੈਡਮ ਫਿਰ ਵੀ ਕਿੰਨੀ ਕੁ ਪਰਸਨਟ ਚਾਂਸ ਹੈਗੇ ਮੈਂ ਕਰ ਸਕਦੀ ਹਾਂ ਠੀਕ ਹੈ ਮੈਮ ਓਕੇ ਮੈਮ ਥੈਂਕ ਯੂ ਮੈਮ ਹਾਂਜੀ ਨਹੀਂ ਨਹੀਂ ਮੈਂ ਕੋਈ ਅਰਜੈਂਟ ਵਰਕ ਨਹੀਂ ਸੀਗਾ ਸੋਰੀ ਮੈਮ ਮੈਂ ਸਿਰਫ ਸਿਕ ਲੀਵ ਵਾਸਤੇ ਹੀ ਐਪਲੀਕੇਸ਼ਨ ਦਿੱਤੀ ਸੀਗੀ ਅਦਰਵਾਈਜ਼ ਮੈਂ ਓ ਓਦਾਂ ਨਹੀਂ ਕਦੀ ਵੀ ਐਬਸੈਂਟ ਹੁੰਦੀ ਹੈਗੀ ਠੀਕ ਹੈ ਠੀਕ ਹੈ ਮੈਮ ਠੀਕ ਹੈ ਮੈਮ ਓਕੇ ਮੈਮ ਓਕੇ ਮੈਮ ਥੈਂਕ ਯੂ ਮੈਮ ਓਕੇ ਜੀ